ਪੰਜਾਬ ਵਿੱਚ ਖੇਤੀਬਾੜੀ ਬਹੁਤ ਹੀ ਵੱਡਾ ਸਾਧਨ ਹੈ ਕਮਾਈ ਦਾ ਅਤੇ ਪਿੰਡ ਦੇ ਪਿੰਡਾਂ ਦੇ ਨੌਜਵਾਨ ਇਸਨੂੰ ਬਹੁਤ ਹੀ ਸੀਰੀਅਸ ਹੁਣ ਲੈਣ ਲੱਗ ਗਏ ਹਨ ਕਿਉਂਕਿ ਜ਼ਿਆਦਾਤਰ ਨੌਜਵਾਨ ਹੁਣ ਕਨੇਡਾ ਅਮਰੀਕਾ ਆਸਟ੍ਰੇਲੀਆ ਜਾ ਰਹੇ ਹਨ ਵਿਦੇਸ਼ਾਂ ਵਿੱਚ ਜੋ ਇੱਥੇ ਰਹਿ ਗਏ ਹਨ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਹੈ ਅੱਗੇ ਅੱਗੇ ਕਿੰਨੇ ਸੁਧਾਰ ਆ ਰਹੇ ਹਨ ਖੇਤੀ ਵਿੱਚ ਨਵੀਆਂ ਤਕਨੀਕਾਂ ਆ ਰਹੀਆਂ ਹਨ ਜਿਸ ਨਾਲ ਖੇਤੀ ਖੇਤੀ 'ਚ ਵਾਧਾ ਹੋ ਰਿਹਾ ਹੈ ਅਤੇ ਇੱਥੇ ਹੀ ਬਹੁਤ ਵਧੀਆ ਖੇਤੀ ਦਾ ਸ ਖੇਤੀ ਵਜੋਂ ਕਮਾਈ ਦਾ ਬਹੁਤ ਵਧੀਆ ਸਾਧਨ ਬਣ ਰਿਹਾ ਹੈ ਜਿਸ ਵਿੱਚ ਨੌਜਵਾਨ ਆਪਣੇ ਹੱਥ ਦੀ ਕਮਾਈ ਕਰਕੇ ਆਪਣਾ ਜਿੰਨਾ ਉਹ ਮਿਹਨਤ ਕਰੋਂਗੇ ਉੱਨੇ ਹੀ ਉਹ ਉਹਦਾ ਫਲ਼ ਪਾਊਂਗੇ ਖੇਤੀ ਖੇਤੀ ਬਹੁਤ ਵਧੀਆ ਹੁੰਦੀ ਹੈ ਜੀ ਬਸ ਕਿਆ ਦੱਸੀਏ